ਪੰਜਾਬ ਦੀ ਸੰਸਕ੍ਰਿਤੀ 'ਤੇ ਉਸਦੀ ਆਬਾਦੀ ਦਾ ਕੋਈ ਵੀ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਜੋ ਪੰਜਾਬ ਦੇ ਲੋਕ ਹਨ ਅਤੇ ਉਸਦੀ ਸੰਸਕ੍ਰਿਤੀ ਬਹੁਤ ਹੀ ਮਿਲਣ ਵਰਤਣ ਵਾਲ਼ੀ ਹੈ ਪੰਜਾਬ ਦੇ ਪਹਿਲਾਂ ਦੇ ਲੋਕ ਅਤੇ ਹੁਣ ਦੇ ਲੋਕ ਸਾਰੇ ਜੋ ਹੈ ਉਹ ਬਹੁਤ ਹੀ ਖੁਸ਼ ਮਿਜ਼ਾਜ ਲੋਕ ਹਨ ਜੋ ਆਪਸ ਵਿੱਚ ਮਿਲ ਵਰਤ ਕੇ ਰਹਿਣਾ ਪਸੰਦ ਕਰਦੇ ਹਨ ਇੱਥੋਂ ਦੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਸਾਰੇ ਹੀ ਬਹੁਤ ਹੀ ਮਿਲ ਵਰਤਣ ਵਾਲ਼ੇ ਹਨ ਪਿਛਲੇ ਪੰਜਾਬ ਦੇ ਲੋਕ ਬਹੁਤ ਹੀ ਮਿਲ ਵਰਤ ਕੇ ਰਹਿਣਾ ਪਸੰਦ ਕਰਦੇ ਸੀ ਅਤੇ ਦੇਖਿਆ ਜਾਵੇ ਤਾਂ ਅੱਜ ਦੇ ਵੀ ਪੰਜਾਬੀ ਲੋਕ ਬਹੁਤ ਹੀ ਖੁਸ਼ ਮਿਜ਼ਾਜ ਅਤੇ ਮਿਲਵਰਤਨ ਵਾਲ਼ੇ ਲੋਕ ਹਨ